ਤੈਰਾਕੀ ਤੋਂ ਪਹਿਲਾਂ ਚਿੰਤਾ ਨੂੰ ਸੰਭਾਲਨਾ ਚੁਣੌਤੀਪੂਰਨ ਹੋ ਸਕਦਾ ਪਰ ਇੱਥੇ ਕੁਝ ਰਣਨੀਤੀਆਂ ਤੁਹਾਡੀ ਮਦਦ ਕਰ ਸਕਦੀਆਂ ਹਨ ਤੈਰਨ ਤੋਂ ਪਹਿਲਾਂ ਦੀ ਦੀਆਂ ਰਣਨੀਤੀਆਂ ਹੇਠ ਲਿਖੇ ਅਨੁਸਾਰ ਹਨ ਸਾਹ ਲੈਣ ਦੀਆਂ ਕਸਰਤਾਂ ਦ੍ਰਿਸ਼ਟੀਕਰਨ ਸਰਕਾਰਮਤ ਸਵੈ ਗੱਲਬਾਤ ਸਰੀਰਕ ਵਾਰਮ ਅਪ ਅਤੇ ਇਸ ਤੋਂ ਇਲਾਵਾ ਤੈਰਾਕੀ ਦੌਰ ਤੋਂ ਪਹਿਲਾਂ ਦੀ ਰੂਟੀਨ ਇੱਕ ਪੇਸ਼ੇਵਾਰੀ ਤੈਰਾਕੀ ਮੁਕਾਬਲਾ ਕਰਨਾ ਹਾਲਾਂਕਿ ਮੇਰਾ ਨਿੱਜੀ ਅਨੁਭਵ ਨਹੀਂ ਹੈ ਪਰ ਮੈਂ ਸਹੂਲਤ ਲਈ ਸੂਝ ਪ੍ਰਦਾਨ ਕਰ ਸਕਦਾ ਹਾਂ ਕਿ ਕੋਈ ਪੇਸ਼ੇਵਰ ਤੈਰਾਕੀ ਮੁਕਾਬਲੇ ਵਿੱਚ ਕਿਉਂ ਹਿੱਸਾ ਲੈਣਾ ਚਾਹੁੰਦੇ ਹਨ ਉਹ ਹਨ ਚੁਣੌਤੀ ਅਤੇ ਪ੍ਰਾਪਤੀ ਲਈ ਨਿੱਜੀ ਵਿਕਾਸ ਲਈ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਜੇਕਰ ਤੁਸੀਂ ਤੈਰਾਕੀ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਮੈਂ ਤੁਹਾਨੂੰ ਸਫਲਤਾ ਲਈ ਕੁਝ ਕੁ ਗੁਣ ਦੱਸਣਾ ਚਾਹੁੰਦਾ ਉਹ ਇਸ ਸਮਰਪਣ ਅਤੇ ਅਨੁਸ਼ਾਸਨ ਲਚਕੀਲਾਪਣ ਅਤੇ ਅਨੁਕੂਲਤਾ ਧਿਆਨ ਅਤੇ ਇਕਾਗਰਤਾ ਜਨੂੰਨ ਅਤੇ ਆਨੰਦ ਤਾਂ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ